ਮੇਰੀ ਮਨਪਸੰਦ ਥਾਂ ਰੋਪੜ ਹੈੱਡ ਹੈ ਅਤੇ ਇੱਥੇ ਮੈਂ ਰੋਜ਼ ਹਰ ਰੋਜ਼ ਘੁੰਮਣ ਆਉਂਦਾ ਕਿਉਂਕਿ ਇੱਥੇ ਦਾ ਵੀਊ ਬਹੁਤ ਵਧੀਆ ਹੈ ਅਤੇ ਇੱਥੇ ਦੇਖਣ ਲਈ ਕੁਦਰਤੀ ਸਰੋਤ ਅਤੇ ਘੁੰਮਣ ਫਿਰਨ ਲਈ ਬਹੁਤ ਵਧੀਆ ਥਾਂ ਹੈ ਅਤੇ ਵੇਰਕਾ ਬੂਥ ਵੀ ਆ ਜਿੱਥੋਂ ਅਸੀਂ ਖਾ ਪੀ ਵੀ ਸਕਦੇ ਹਾਂ ਅਤੇ ਹੋਰ ਇੱਥੋਂ ਦੀਆਂ ਰ ਹੋਰ ਲੋਕਲ ਦੇ ਖਾਣ ਪੀਣ ਲਈ ਬਹੁਤ ਸ਼ੋਪਸ ਨੇ